ਸੱਤ ਜੂਨ ਉੱਨੀ ਸੌ ਛਿੱਅਤਰ ਤੇਰਾਂ ਨਵੰਬਰ ਅਠਾਰਾਂ ਸੌ ਇਕੱਤੀ ਛੱਬੀ ਜਨਵਰੀ ਉੱਨੀ ਸੌ ਚੁਤਾਲੀ ਇਕੱਤੀ ਦਸਬੰਰ ਦੋ ਹਜ਼ਾਰ ਦੋ ਇੱਕ ਜੂਨ ਉੱਨੀ ਸੌ ਛਿਆਹਠ